ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਵਿੱਚ ਭੀੜ ਭੜੱਕੇ ਅਤੇ ਘੱਟ ਫੰਡਿੰਗ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਰਕਾਰ ਕਾਫੀ ਉਪਰਾਲੇ ਕਰ ਰਹੀ ਹੈ ਜਿਵੇਂ ਕਿ ਸਕੂਲਾਂ ਦੇ ਵਿੱਚ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਵੀ ਸਮਾਰਟ ਕਲਾਸਾਂ ਲਗਾਈਆਂ ਗਈਆਂ ਹਨ ਅਤੇ ਲੈਬ ਸਾਇੰਸ ਲੈਬ ਕੰਪਿਊਟਰ ਲੈਬ ਵਗੈਰਾ ਦਾ ਆਧੁਨਿਕੀਕਰਨ ਕੀਤਾ ਗਿਆ ਹੈ ਤਾਂ ਕਿ ਬੱਚਿਆਂ ਨੂੰ ਜਿਹੜੀ ਆ ਵਧੀਆ ਸਿੱਖਿਆ ਘੱਟ ਪੈਸਿਆਂ 'ਤੇ ਮੁਹੱਈਆ ਕੀਤੀ ਜਾਵੇ ਕੁਝ ਸਮੱਸਿਆ ਬੱਚਿਆਂ ਨੂੰ ਸਕੂਲ ਵਿੱਚ ਖਿੱਚਣ ਵਾਸਤੇ ਜਿਹੜੀ ਹੈ ਛੋਟੇ ਬੱਚੇ ਪੰਜਵੀਂ ਤੱਕ ਦੇ ਪ੍ਰਾਇਮਰੀ ਤੱਕ ਦੇ ਬੱਚਿਆਂ ਨੂੰ ਮਿਡ ਡੇ ਮੀਲ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ ਤਾਂ ਕਿ ਜੋ ਗਰੀਬ ਘਰਾਂ ਦੇ ਬੱਚੇ ਹਨ ਉਹ ਖਾਣਾ ਖਾਣ ਲਈ ਹੀ ਭਾਵੇਂ ਸਕੂਲ ਆਉਣ ਅਤੇ ਬਾਅਦ ਵਿੱਚ ਉਹਨਾਂ ਨੂੰ ਸਿੱਖਿਆ ਵੱਲ ਲਗਾਇਆ ਜਾਵੇ ਤਾਂ ਕਿ ਉਹ ਚਾਇਲਡ ਲੇਬਰ ਨਾ ਕਰਨ ਨਹੀਂ ਤਾਂ ਕਈ ਵਾਰੀ ਜਿਹੜੇ ਗਰੀਬ ਘਰ ਨੇ ਉਹ ਰੋਟੀ ਖਾਣ ਲਈ ਆਪਣੇ ਬੱਚੇ ਨੂੰ ਹੀ ਕੰਮ ਕਾਜ 'ਤੇ ਲਗਾ ਦਿੰਦੇ ਹਨ ਅਤੇ ਚਾਇਲਡ ਲੇਬਰ ਨੂੰ ਘਟਾਉਣ ਲਈ ਸਿੱਖਿਆ ਪ੍ਰਣਾਲੀ ਵਿੱਚ ਇਹ ਵੀ ਇੱਕ ਅਹਿਮ ਭੂਮਿਕਾ ਨਿਭਾਈ ਗਈ ਹੈ ਜਿਹੜਾ ਕਿ ਮਿਡ ਡੇ ਮੀਲ ਦੀ ਸਹੂਲਤ ਦਿੱਤੀ ਗਈ ਹੈ ਘੱਟ ਫੰਡਿੰਗ ਦੀ ਸਮੱਸਿਆ ਅਜੇ ਵੀ ਜਾਰੀ ਹੈ ਕਿਉਂਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਰਾਜ ਸਰਕਾਰ ਨੂੰ ਪੂਰੇ ਜਿਹੜੇ ਉਹ ਹੱਕ ਨਹੀਂ ਦਿੱਤੇ ਜਾਂਦੇ ਜਿਹੜੀ ਹੈ ਕਈ ਫੰਡਿੰਗ ਦੀ ਘਾਟ ਕਰਕੇ ਸਟਾਫ ਘੱਟ ਹੁੰਦਾ ਕਈ ਸਰਕਾਰੀ ਸਕੂਲਾਂ ਦੇ ਵਿੱਚ ਅਤੇ ਉਹਦੇ ਕਰਕੇ ਜਿਹੜਾ ਬੱਚਿਆਂ ਦਾ ਇੰਟਰਸਟ ਆ ਉਹ ਇੰਨਾ ਵਧੀਆ ਨਹੀਂ ਬਣਦਾ ਉੱਥੇ ਇਸ ਕਰਕੇ ਚਲੋ ਫੰਡਿੰਗ ਦੀ ਫੇਰ ਵੀ ਜਿਹੜੀ ਆ ਉਹ ਪੇਰੈਂਟਸ ਨੂੰ ਵੀ ਅਵੇਅਰ ਕੀਤਾ ਜਾ ਰਿਹਾ ਕਿ ਟਾਈਮ ਸਿਰ ਫੀਸਾਂ ਦੇਣ ਭਾਵੇਂ ਥੋੜ੍ਹੀਆਂ ਹੀ ਨੇ ਪਰ ਉਹ ਵੀ ਕਈ ਵਾਰੀ ਪੇਰੈਂਟਸ ਜਿਹੜੇ ਉਹ ਫੀਸਾਂ ਨਹੀਂ ਦਿੰਦੇ ਉਹਨਾਂ ਨੂੰ ਵੀ ਪੇਰੈਂਟਸ ਮੀਟਿੰਗਾਂ ਕਰ ਕਰ ਕੇ ਅਵੇਅਰ ਕੀਤਾ ਜਾ ਰਿਹਾ ਕਿ ਟਾਈਮ ਸਿਰ ਫੀਸਾਂ ਦੇਣ ਅਤੇ ਬਾਕੀ ਕੇਂਦਰ ਸਰਕਾਰਾਂ ਦੀ ਵੀ ਥੋੜ੍ਹੀ ਜਿਹੀ ਮਦਦ ਚਾਹੀਦੀ ਹੈ ਤਾਂ ਕਿ ਰਾਜ ਸਰਕਾਰਾਂ ਦੀ ਫੰਡਿੰਗ ਦੀ ਸਮੱਸਿਆ ਹੱਲ ਹੋ ਸਕੇ